ਹਾਂਜੀ ਉਹ ਸਾਡੇ ਇੱਥੇ ਸ਼ਹਿਰ ਦੇ ਵਿੱਚ ਜਿਹੜੇ ਪਾਣੀ ਦੀ ਸਪਲਾਈ ਆ ਉਹ ਕਿਸ ਕਿਸ ਤਰ੍ਹਾਂ ਹੈ ਕਿਸ ਸਮੇਂ ਕਿਸ ਟਾਈਮ ਆਉਂਦੀ ਹੈ ਅਤੇ ਕਿਸ ਕਿਸ ਟਾਈਮ ਆਉਂਦੀ ਆ ਔਰ ਇਹ ਪਾਣੀ ਦਾ ਪਾਣੀ ਜਿਹੜਾ ਆਉਂਦਾ ਇਹਦਾ ਕੋਈ ਬਿੱਲ ਵਗੈਰਾ ਆਉਂਦਾ ਹਾਂ ਅੱਛਾ ਹਾਂ ਸਾਢੇ ਛੇ ਸੌ ਤਾਂ ਚਲੋ ਬਿੱਲ ਠੀਕ ਹੈ ਅੱਛਾ ਜੀ ਚਲੋ ਠੀ ਠੀਕ ਹੈ ਫਿਰ